ਦੇਖੋ ਜੀ ਪਸ਼ੂ ਪਾਲਣ ਦਾ ਇੱਕ ਕਿੱਤਾ ਬਹੁਤ ਹੀ ਵਧੀਆ ਔਰ ਸ਼ਾਨਦਾਰ ਹੈ ਜੀ ਜਿਹਦੇ ਵਿੱਚੋਂ ਅਸੀਂ ਆਪਣੇ ਘਰ ਲਈ ਵੀ ਦੁੱਧ ਰੱਖ ਸਕਦੇ ਹਾਂ ਔਰ ਬਾਹਰ ਵੇਚ ਵੀ ਸਕਦੇ ਹਾਂ ਜਿਹਦੇ ਨਾਲ ਬਹੁਤ ਫਾਇਦਾ ਹੁੰਦਾ ਹੈ ਮੁਰਗੀਆਂ ਦਾ ਵੀ ਇੱਕ ਸ਼ੈਡ ਪਾ ਕੇ ਮੁਰਗੀਆਂ ਸੌ ਪੰਜਾਹ ਮੁਰਗੀਆਂ ਬੰਦਾ ਰੱਖ ਲਏ ਜਿਹਦੇ ਨਾਲ ਇੰਨਾ ਖਰਚਾ ਵੀ ਨਹੀਂ ਆਉਂਦਾ ਔਰ ਤੁਹਾਡਾ ਖਰਚਾ ਬਹੁਤ ਵਧੀਆ ਢੰਗ ਨਾਲ ਚੱਲਦਾ ਜੀ ਜਿਹਦੇ ਵਿੱਚੋਂ ਸੂਰ ਲੋਕਾਂ ਨੇ ਅਗਰ ਅਲੱਗ ਜਗ੍ਹਾ ਹੋਏ ਸੂਰ ਦਾ ਵੀ ਧੰਦਾ ਬਹੁਤ ਵਧੀਆ ਜਿਹਦੇ ਨਾਲ ਖ ਖਰਚਾ ਘੱਟ ਹੈ ਔਰ ਸੂਰ ਦਾ ਮੀਟ ਬਾਜ਼ਾਰ 'ਚ ਬਹੁਤ ਵਿਕਦਾ ਜੀ ਜਿਹਦੇ ਨਾਲ ਉਹ ਜਲਦੀ ਹੀ ਵੱਡੇ ਹੋ ਜਾਂਦੇ ਆ ਜਲਦੀ ਹੀ ਵੱਡੇ ਹੋਣ ਦੇ ਨਾਲ ਔਰ ਕਾਫੀ ਹੱਦ ਤੱਕ ਫੈਲ ਜਾਂਦੇ ਆ ਜਿਹਦੇ ਨਾਲ ਬਹੁਤ ਹੀ ਮੁਨਾਫਾ ਮਿਲਦਾ ਜਿਹਦੇ ਨਾਲ ਕਿਸਾਨ ਨੂੰ ਇੰਨੀ ਰਕਮ ਵੀ ਨਹੀਂ ਲਾਉਣੀ ਪੈਂਦੀ ਔਰ ਫਾਇਦਾ ਵੀ ਬਹੁਤ ਸਹੀ ਔਰ ਵਧੀਆ ਮਿਲਦਾ ਜੀ ਇਸ ਕਾਰਨ ਬਹੁਤ ਵਧੀਆ ਧੰਦਾ ਜੀ